ਹਰੇਕ ਧਰਮ ਹਰੇਕ ਜਾਤ ਹਰੇਕ ਮਜ਼ਹਬ ਦੇ ਆਪਣੇ ਆਪਣੇ ਰੀਤੀ ਰਿਵਾਜ਼ ਮਰਿਆਦਾਵਾਂ ਹਨ ਪਰੰਤੂ ਪੰਜਾਬੀ ਸੱਭਿਆਚਾਰ ਜਾਂ ਸਿੱਖ ਧਰਮ ਵਿੱਚ ਅਸੀਂ ਦੇਖਦੇ ਹਾਂ ਕਿ ਰੰਗੋਲੀ ਸੂਰਜ ਨੂੰ ਪਾਣੀ ਚੜ੍ਹਾਉਣਾ ਪਵਿੱਤਰ ਧਾਗੇ ਪਾਉਣਾ ਇਸ ਸਭ ਦਾ ਖੰਡਨ ਕੀਤਾ ਗਿਆ ਹੈ ਕਿਉਂਕਿ ਸਿੱਖ ਧਰਮ ਦਾ ਜੋ ਅਸਲ ਮਕਸਦ ਹੈ ਉਹ ਹੈ ਅਕਾਲ ਪੁਰਖ ਨਾਲ ਜੋੜਨਾ ਇਸ ਲਈ ਇਹ ਕਰਮ ਕਾਂਡਾਂ ਦੀ ਉਸ ਵਿੱਚ ਕੋਈ ਵਡਿਆਈ ਨਹੀਂ ਕੀਤੀ ਗਈ ਸਿੱਖ ਮਰਿਆਦਾ ਅਨੁਸਾਰ ਸਿਰਫ ਰੱਬ ਨਾਲ ਜੁੜਨਾ ਹੈ ਇਸ ਲਈ ਸਾਨੂੰ ਕਰਮ ਕਾਂਡ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਸ ਲਈ ਸਿਰਫ ਆਪਣਾ ਨਾਮ ਜਪਣਾ ਚਾਹੀਦਾ ਹੈ ਪਰਮਾਤਮਾ ਦੇ ਵਿੱਚ ਲੀਨ ਰਹਿਣਾ ਚਾਹੀਦਾ ਹੈ ਨਾਮ ਜ ਕਰਨ ਜਪਣ ਦੇ ਨਾਲ ਨਾਲ ਹੀ ਕਿਰਤ ਵੀ ਕਰਨੀ ਚਾਹੀਦੀ ਹੈ ਅਤੇ ਜੋ ਕਿਰਤ ਵਿੱਚੋਂ ਸਾਨੂੰ ਲਾਭ ਪ੍ਰਾਪਤ ਹੋਇਆ ਹੈ ਉਸ ਨੂੰ ਸਭ ਨਾਲ ਵੰਡ ਕੇ ਛੱਕਣਾ ਚਾਹੀਦਾ ਹੈ